ਪਿੰਡ ਗੁਰਨੇ ਕਲਾਂ ਵਿਖੇ ਕਬੂਤਰਬਾਜੀ ਮੁਕਾਬਲਾ ਸੀ ਮੈਂ ਵੀ ਉੱਥੇ ਮੁਕਾਬਲੇ ਵਿੱਚ ਹਿੱਸਾ ਲਿੱਤਾ ਸੀ ਅਤੇ ਮੈਨੂੰ ਫਸਟ ਪ੍ਰਾਈਜ ਵੀ ਮਿਲਿਆ ਇਹ ਦਿਨ ਮੇਰੇ ਲਈ ਬਹੁਤ ਹੀ ਸ਼ਾਨਦਾਰ ਰਿਹਾ ਮੈਨੂੰ ਇਹ ਇਹ ਕਰਕੇ ਬਹੁਤ ਖੁਸ਼ੀ ਮਿਲੀ ਅਤੇ ਘਰਦੇ ਵੀ ਬਹੁਤ ਖੁਸ਼ ਹੋਏ ਇਹ ਦਿਨ ਮੇਰੇ ਲਈ ਬਹੁਤ ਸ਼ਾਨਦਾਰ ਰਿਹਾ ਇਹ ਕਬੂਤਰਬਾਜੀ ਮੁਕਾਬਲਾ ਮੇਰੇ ਲਈ ਬਹੁਤ ਵਧੀਆ ਉੱਥੇ ਪੰਜਾਹ ਤੋਂ ਵੀ ਵੱਧ ਬੰਦੇ ਸੀ ਅਤੇ ਸਾਰਿਆਂ ਦੇ ਚਿਹਰਿਆਂ 'ਤੇ ਬਹੁਤ ਹੀ ਸੋਹਣੀ ਮੁਸਕਰਾਹਟ ਸੀ ਅਤੇ ਉੱਥੇ ਪ੍ਰਾਈਜ ਵੀ ਬਹੁਤ ਸੀ ਜਿਵੇਂ ਕਿ ਟਰੋਫੀਆਂ ਹੋਰ ਵੀ ਕੋਈ ਇਨਾਮ ਸੀਗੇ ਅਤੇ ਉੱਥੇ ਇਹ ਉੱਥੇ ਹੋਰ ਵੀ ਜਣਿਆਂ ਨੇ ਹਿੱਸਾ ਲਿੱਤਾ ਸੀ ਕਈ ਵਿੱਚ ਕਈ ਹਾਰ ਗਏ ਅਤੇ ਕਈ ਜਿੱਤ ਕੇ ਗਏ ਅਤੇ ਉੱਥੇ ਸਾਰਿਆਂ ਦੇ ਬਹੁਤ ਨਜ਼ਾਰਾ ਆਇਆ